ਸਤਿ ਸ੍ਰੀ ਅਕਾਲ ਜੀ ਮੈਂ ਰਿਟਾਇਰਮੈਂਟ ਇੱਕ ਐਕਸਮੈਨ ਹਾਂ ਔਰ ਅਮੂਮਨ ਸਾਨੂੰ ਆਰਮੀ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਦੋਂ ਬੰਦਾ ਸਰੀਰਕ ਤੌਰ 'ਤੇ ਔਰ ਮਾਨਸਿਕ ਤੌਰ 'ਤੇ ਤੰਦਰੁਸਤ ਹੈ ਤਾਂ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਕੋਈ ਵੀ ਕੰਮ ਹੈ ਉਹਨੂੰ ਸਫਲਤਾ ਪੂਰਵਕ ਔਰ ਆਸਾਨੀ ਦੇ ਨਾਲ ਕਰ ਸਕਦਾ ਹੈ ਜਿਵੇਂ ਕਿ ਅਸੀਂ ਅੱਜ ਕੱਲ ਦੇਖਦੇ ਹਾਂ ਤੇਜ਼ੀ ਦਾ ਯੁੱਗ ਸਾਨੂੰ ਤੇਜ਼ੀ ਦੇ ਯੁੱਗ ਦੇ ਵਿੱਚ ਵਿਚਰਨ ਵਾਸਤੇ ਸਾਨੂੰ ਆਪਣੀ ਸਿਹਤ ਦਾ ਔਰ ਆਲੇ ਦੁਆਲੇ ਦਾ ਖਿਆਲ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਸਹੀ ਟਾਈਮ 'ਤੇ ਸੌਵੋ ਔਰ ਸਹੀ ਟਾਈਮ 'ਤੇ ਉੱਠੋ ਅਗਰ ਅਸੀਂ ਸਹੀ ਟਾਈਮ 'ਤੇ ਸੌਵਾਂਗੇ ਤਾਂ ਅਸੀਂ ਸਹੀ ਟਾਈਮ 'ਤੇ ਉੱਠ ਸਕਾਂਗੇ ਉੱਠ ਕੇ ਸਭ ਤੋਂ ਪਹਿਲਾਂ ਆਪਣਾ ਜੋ ਹੈ ਵਾਹਿਗੁਰੂ ਦਾ ਨਾਮ ਲੈਣਾ ਔਰ ਉਸ ਤੋਂ ਬਾਅਦ ਆਪਣਾ ਦਿਨਚਰਿਆ ਦੇ ਹਿਸਾਬ ਨਾਲ ਰੋਜ਼ਾਨਾ ਵਾਕਿੰਗ ਕਰੋ ਔਰ ਕੁਛ ਕੁ ਯੋਗਾ ਕਸਰਤ ਕੁਛ ਨਾ ਕੁਛ ਸਾਨੂੰ ਕਰਨਾ ਚਾਹੀਦਾ ਹੈ ਔਰ ਉਸ ਤੋਂ ਬਾਅਦ ਅਸੀਂ ਆਪਣਾ ਇਹ ਕਾਰਵਾਈ ਕਰਨ ਤੋਂ ਬਾਅਦ ਹਮੇਸ਼ਾ ਜਿੱਥੇ ਤੱਕ ਹੋ ਸਕੇ ਅਸੀਂ ਆਪਣੇ ਘਰ ਦਾ ਹੀ ਖਾਣ ਪਾਣ ਆਪਣਾ ਬਣਾ ਕੇ ਹੀ ਖਾਂਦੇ ਹਾਂ ਔਰ ਬਾਕੀ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਫਾਲਤੂ ਦਾ ਭੋਜਨ ਔਰ ਬਾਰਸ਼ ਦੀ ਬਾਹਰ ਦੀਆਂ ਵਿਅਰਥ ਦੀਆਂ ਚੀਜਾਂ ਅਸੀਂ ਨਹੀਂ ਖਾਂਦੇ ਕੰਟੀਨਿਊ ਰੋਜ਼ ਹਰ ਰੋਜ਼ ਜੋ ਸਵੇਰੇ ਦੀ ਕਿਰਿਆ ਹੈ ਦੁਪਹਿਰ ਦੀ ਹੈ ਉਹਨੂੰ ਰੋਟੀਨ ਵਰਕ ਰੱਖਣਾ ਚਾਹੀਦਾ ਹੈ ਤਾਂ ਜੋ ਸਾਡਾ ਸਮਾਂ ਸਹੀ ਲੰਘ ਸਕੇ ਅਸੀਂ ਦੇਖਦੇ ਹਾਂ ਕਿ ਵਾਤਾਵਰਨ ਬਹੁਤ ਖ਼ਰਾਬ ਹੈ ਜਿਹਦੇ ਕਾਰਨ ਸਾਨੂੰ ਅਲੱਗ ਅਲੱਗ ਪ੍ਰਕਾਰ ਦੀਆਂ ਬਿਮਾਰੀਆਂ ਲੱਗੀਆਂ ਹਨ ਜੇਕਰ ਅਸੀਂ ਆਪਣੀ ਰੋਟੀਨ ਵਰਕ ਸਹੀ ਰੱਖਾਂਗੇ ਤਾਂ ਸਾਨੂੰ ਬਿਮਾਰੀਆਂ ਦਾ ਸਾਹਮਣਾ ਕਰਨ ਦੀ ਬਹੁਤ ਘੱਟ ਜ਼ਰੂਰਤ ਪਵੇਗੀ ਔਰ ਅਸੀਂ ਰੋਜ਼ਮਰਾ ਦੀ ਜੋ ਜ਼ਿੰਦਗੀ ਹੈ ਉਹਦੇ ਵਿੱਚ ਅਸੀਂ ਸਹੀ ਕਾਰਵਾਈ ਕਰਾਂਗੇ ਤਾਂ ਅਸੀਂ ਤੰਦਰੁਸਤ ਵੀ ਰਹਾਂਗੇ